ਮੇਰੀ ਜਾਣਕਾਰੀ 'ਚ ਅਤੇ ਮੈਂ ਵਿਗਿਆਨ ਅਤੇ ਗਣਿਤ ਦੇ ਬਹੁਤ ਕਲ ਟਿਊਸ਼ਨ ਲਾਈਆਂ ਅਤੇ ਕਲਾਸਾਂ ਲਾਈਆਂ ਹਨ ਕਿਉਂਕਿ ਇਹ ਥੋੜ੍ਹਾ ਜਿਹਾ ਔਖਾ ਸਬਜੈਕਟ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਟੀਚਰ ਜ਼ਿਆਦਾ ਸਟਾਰਟਿੰਗ ਤੋਂ ਹੀ ਬੱਚਿਆਂ ਦਾ ਬੇਸ ਇੰਨਾ ਨਹੀਂ ਬਣਿਆ ਹੁੰਦਾ ਕਿ ਉਹ ਜ਼ਿਆਦਾ ਵਿਗਿਆਨ ਜਾਂ ਮੈਥ 'ਚ ਜ਼ਿਆਦਾ ਪੜ੍ਹ ਸਕਣ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਕਿਉਂਕਿ ਉਹ ਸਟਾਰਟਿੰਗ ਜਦੋਂ ਉਹਨਾਂ ਦੇ ਪੇਰੈਂਟਸ ਆ ਬਹੁਤ ਘੱਟ ਪੜ੍ਹੇ ਹੋਏ ਹਨ ਜਿਸ ਕਰਕੇ ਉਹ ਵੱਧ ਤੋਂ ਵੱਧ ਆਪਦੇ ਜਵਾਕਾਂ ਨੂੰ ਸਾਇੰਸ ਵਿਗਿਆਨ ਜਾਂ ਗਣਿਤ ਨਹੀਂ ਪੜ੍ਹਾ ਸਕਦੇ ਵਿਗਿਆਨ ਅਤੇ ਗਣਿਤ ਪੜ੍ਹਨ ਲਈ ਸਾਨੂੰ ਬਹੁਤ ਹੀ ਐਜੂਕੇਟਡ ਟੀਚਰ ਪੇਰੈਂਟਸ ਦੀ ਲੋੜ ਹੁੰਦੀ ਹੈ ਪਰ ਜਦੋਂ ਇਗਜ਼ਾਮ ਦੇ ਟਾਈਮ ਜਾਂ ਜਦੋਂ ਆਪਾਂ ਪ੍ਰਾਇਮਰੀ ਅਤੇ ਸੈਕੰਡਰੀ ਵੱਲ ਜਾਂਦੇ ਹਾਂ ਤਾਂ ਮੈਥ ਅਤੇ ਸਾਇੰਸ ਬਹੁਤ ਜ਼ਿਆਦਾ ਔਖੇ ਸਬਜੈਕਟ ਹੋ ਜਾਂਦੇ ਹਨ ਜਿਸ ਕਰਕੇ ਸਾਨੂੰ ਅਲੱਗ ਅਲੱਗ ਕਲਾਸਾਂ ਅਤੇ ਟਿਊਸ਼ਨਾਂ ਲਾਉਣ ਦੀ ਲੋੜ ਪੈਂਦੀ ਹੈ ਟਿਊਸ਼ਨਾਂ ਅਤੇ ਕਲਾਸਾਂ 'ਚ ਜਾ ਕੇ ਬੱਚੇ ਇਨ ਇਹਨਾਂ ਦੇ ਮਹੱਤਵਪੂਰ ਮਹੱਤਵ ਮਹੱਤਤਾ ਬਾਰੇ ਪੜ੍ਹਦੇ ਹਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਬੇਸਿਕ ਨੋਲੇਜ ਆਪਦੀ ਪ੍ਰਾਪਤ ਕਰਦੇ ਹੈ ਜਿਸ ਨਾਲ ਉਹ ਪੇਪਰਾਂ ਵਿੱਚ ਅਤੇ ਉਹਨਾਂ ਨੂੰ ਅੱਗੋਂ ਉਹਨਾਂ ਦੀ ਨੌਲੇਜ ਵੱਧਦੀ ਹੈ ਮੈਥ ਅਤੇ ਸਾਇੰਸ ਭਾਰਤ ਵਿੱਚ ਔਖੇ ਸਬਜੈਕਟ ਮੰਨੇ ਜਾਂਦੇ ਨੇ ਕਈ ਵਾਰ ਸਟੂ ਜਵਾਕ ਜਾਂ ਬੱਚੇ ਇਹ ਸਬਜੈਕਟ ਲੈਣਾ ਪਸੰਦ ਨਹੀਂ ਕਰਦੇ ਜੇ ਉਹਨਾਂ ਨੇ ਕੋਈ ਅੱਗੋਂ ਆਪਦੀ ਡਿਗਰੀ ਜਾਂ ਕੋਈ ਵੀ ਸਕੂਲਿੰਗ ਕਰਨੀ ਹੈ ਪਲੱਸ ਵਨ ਟੂ ਤਾਂ ਉਹ ਜਿਵੇਂ ਮੈਡੀਕਲ ਨੋਨ ਮੈਡੀਕਲ ਜਾਂ ਕਮਰਸ ਇਹਨਾਂ ਸਾਰੇ ਵਿਸ਼ੇ ਇਹਨਾਂ ਸਾਰੇ ਸਟਰੀਮ ਵਿੱਚ ਸਾਨੂੰ ਮੈਥ ਅਤੇ ਸਾਇੰਸ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਵਧੀਆ ਕਲਾਸਾਂ ਅਤੇ ਟਿਊਸ਼ਨ ਲਾਈਆਂ ਹਨ ਇਹਦੇ ਨਾਲ ਸਾਨੂੰ ਥੋੜ੍ਹਾ ਬੇਸਿਕ ਕਲੀਅਰ ਹੁੰਦਾ ਅਤੇ ਸਾਨੂੰ ਥੋੜ੍ਹੀ ਮੈਥ ਅਤੇ ਵਿਗਿਆਨ ਦੀ ਨੌਲੇਜ ਮਿਲਦੀ ਹੈ ਵਿਗਿਆਨ ਅਤੇ ਮੈਥ ਨੂੰ ਬਹੁਤ ਡੂੰਘਾਈ ਨਾਲ ਸਾਨੂੰ ਪੜ੍ਹਨਾ ਪੈਂਦਾ ਹੈ ਇਹ ਸਬਜੈਕਟ ਸਮਝਣ ਵਾਲੇ ਸਬਜੈਕਟ ਹੈਗੇ ਹਨ ਅਸੀਂ ਇਹਨਾਂ ਨੂੰ ਆਪਦੇ ਵੱਲੋਂ ਨਹੀਂ ਬਣਾ ਸਕਦੇ ਵਿਗਿਆਨ ਅਤੇ ਗਣਿਤ ਬੋ ਗਣਿਤ ਲਈ ਤਾਂ ਸਾਨੂੰ ਬਹੁਤ ਕਲਾਸਾਂ ਲਾਉਣੀਆਂ ਪੈਂਦੀਆਂ ਹਨ ਜਿਸ ਕਰਕੇ ਸਾਨੂੰ ਤਿੰਨ ਤਿੰਨ ਚਾਰ ਚਾਰ ਕਲਾਸਾਂ ਵੀ ਲਾਉਣੀਆਂ ਪੈਂਦੀਆਂ ਹਨ ਇੱਕ ਅੱਡ ਅੱਡ ਟੀਚਰ ਕੋਲ ਸਾਨੂੰ ਅੱਡ ਅੱਡ ਜਗ੍ਹਾ 'ਤੇ ਜਾ ਕੇ ਪੜ੍ਹਨਾ ਪੈਂਦਾ ਹੈ ਜੋ ਕਿ ਸਾਨੂੰ ਬਹੁਤ ਜ਼ਿਆਦਾ ਸਹਾਇਤਾ ਵੀ ਕਰਦੇ ਹਨ ਅਤੇ ਸਾਡਾ ਟਾਈਮ ਵੀ ਬਹੁਤ ਜ਼ਿਆਦਾ ਇਹਦੇ ਨਾਲ ਯੂਟੀਲਾਈਜ ਵੀ ਹੁੰਦਾ ਅਤੇ ਜਵਾ ਅਤੇ ਅਸੀਂ ਇਜੀਲੀ ਪੜ੍ਹ ਸਕਦੇ ਅਤੇ ਪੇਪਰਾਂ ਲਈ ਵਧੀਆ ਤਿਆਰੀ ਕਰ ਸਕਦੇ ਹਾਂ